ਮੇਰਾ ਮਨਪਸੰਦ ਮਾਰਸ਼ਲ ਆਰਟ ਜੂਡੋ ਹੈ ਕਿਉਂਕਿ ਮੈਂ ਬਚਪਨ ਤੋਂ ਹੀ ਇਸ ਗੇਮ ਨੂੰ ਵੇਖਦਾ ਆ ਰਿਹਾ ਹਾਂ ਪੰਜ ਸਾਲ ਦੀ ਉਮਰ ਤ ਵਿੱਚ ਹੀ ਮੇਰੇ ਘਰ ਵਿੱਚ ਮੇਰੇ ਪਿਤਾ ਜੀ ਦੂਸਰੀ ਵਾਰ ਨੈਸ਼ਨਲ ਲੈਵਲ ਵਿੱਚ ਜਿੱਤੇ ਸਨ ਅਤੇ ਮੈਂ ਉਹਨਾਂ ਦੇ ਵਰਗਾ ਬਣਨਾ ਚਾਹੁੰਦਾ ਸੀ ਸੱਤ ਸਾਲ ਦੀ ਉਮਰ ਵਿੱਚ ਮੈਂ ਪਹਿਲੀ ਵਾਰੀ ਦੋਜੋ ਗਿਆ ਜਿੱਥੇ ਮੈਂ ਮਾਰਸ਼ਲ ਆਰਟਸ ਦੀ ਤਿਆਰੀ ਸ਼ੁਰੂ ਕੀਤੀ ਪਹਿਲਾ ਦਿਨ ਮੇਰਾ ਬਹੁਤ ਹੀ ਵਧੀਆ ਗਿਆ ਮੇਰੇ ਕੋਚ ਸਾਹਿਬ ਨੇ ਮੈਨੂੰ ਧੀਰੇ ਧੀਰੇ ਸਭ ਕੁਛ ਦੱਸਿਆ ਹਰ ਇੱਕ ਚੀਜ਼ ਦੇ ਬਾਰੇ ਡਿਟੇਲ ਵਿੱਚ ਦੱਸਿਆ ਜਾਂਦੇ ਹੋਏ ਅਸੀਂ ਸਟਾਰਟਿੰਗ ਵਿੱਚ ਵੋਰਮਅੱਪ ਕਰਦੇ ਸਨ ਫਿਰ ਵੋਰਮਅੱਪ ਕਰਨ ਤੋਂ ਬਾਅਦ ਅਸੀਂ ਬਹੁਤ ਹੀ ਸਟੈਚਿੰਗ ਕਰਦੇ ਸਨ ਫਿਰ ਰਨਿੰਗ ਹੁੰਦੀ ਸੀ ਅਤੇ ਉਸ ਤੋਂ ਬਾਅਦ ਹੀ ਜਾ ਕੇ ਸਾਨੂੰ ਗੇਮ ਖੇਡਣ ਨੂੰ ਮਿਲਦੀ ਸਨ ਉਸ ਤੋਂ ਬਾਅਦ ਵੀ ਸਾਨੂੰ ਸਟੈਚਿੰਗ ਕਰਨੀ ਪੈਂਦੀ ਸੀ ਅਤੇ ਇਸ ਵਿੱਚ ਮੈਂ ਬਹੁਤ ਹੀ ਖੁਸ਼ ਸਨ ਅਸੀਂ ਹਰ ਦਿਨ ਲਗਭਗ ਲਗਭਗ ਪੰਜ ਤੋਂ ਛੇ ਘੰਟੇ ਦੀ ਪ੍ਰੈਕਟਿਸ ਕਰਦੇ ਸਨ ਉਹ ਵੀ ਦਿਨ ਵਿੱਚ ਦੋ ਵਾਰ ਇੱਕ ਸਵੇਰੇ ਅਤੇ ਇੱਕ ਸ਼ਾਮੀ ਸਮੇਂ ਦੇ ਨਾਲ ਨਾਲ ਮੈਂ ਇਸ ਗੇਮ ਵਿੱਚ ਬਹੁਤ ਹੀ ਵਧੀਆ ਹੁੰਦਾ ਗਿਆ ਅੱਜ ਮੈਂ ਇੱਕ ਸਟੇਟ ਲੈਵਲ ਪਲੇਅਰ ਹਾਂ ਜਿਸ ਨੇ ਚਾਰ ਵਾਰ ਲਗਾਤਾਰ ਸਟੇਟ ਵਿੱਚ ਗੋਲਡ ਲੈ ਕੇ ਆਇਆ ਹਾਂ ਅਤੇ ਮੈਂ ਹਮੇਸ਼ਾ ਹੀ ਇਸ ਚੀਜ਼ ਨੂੰ ਯਾਦ ਰੱਖਾਂਗਾ